ਸਭ ਤੋਂ ਪਹਿਲਾਂ ਤਾਂ ਕੱਪੜਿਆਂ ਨੂੰ ਉਹਨਾਂ ਦੀ ਧਾਤੂ ਅਤੇ ਰੰਗ ਦੇ ਅਧਾਰ 'ਤੇ ਅਲੱਗ ਅਲੱਗ ਕਰ ਲਿਆ ਜਾਂਦਾ ਹੈ ਸਫੇਦ ਕੱਪੜਿਆ ਨੂੰ ਅਲੱਗ ਧੋਇਆ ਜਾਂਦਾ ਹੈ ਅਤੇ ਰੰਗਦਾਰ ਕੱਪੜਿਆਂ ਨੂੰ ਅਲੱਗ ਫਿਰ ਉਹ ਤਾਂ ਤੋਂ ਸਿਲਕ ਹੈ ਕੋਟਨ ਹੈ ਜਾਂ ਕੋਈ ਹੋਰ ਉਸ ਦੇ ਆਧਾਰ 'ਤੇ ਉਹਨਾਂ ਨੂੰ ਅਲੱਗ ਅਲੱਗ ਕੀਤਾ ਜਾਂਦਾ ਹੈ ਸਿਲਕ ਦੇ ਕੱਪੜਿਆਂ ਨੂੰ ਧੋਣ ਧੋਣ ਲੱਗਿਆ ਖਾਸ ਧਿਆਨ ਰੱਖੀਦਾ ਤਾਂ ਕਿ ਉਹ ਉਹਨਾਂ ਦੇ ਧਾਤੂ ਖਰਾਬ ਨਾ ਹੋਵੇ ਜਦਕਿ ਕਾਟਨ ਦੇ ਕੱਪੜਿਆਂ 'ਤੇ ਇੰਨਾ ਧਿਆਨ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਚੰਗੀ ਤਰ੍ਹਾਂ ਰਗੜਿਆ ਜਾਂਦਾ ਹੈ ਇਸ ਤੋਂ ਇਲਾਵਾ ਅਲੱਗ ਅਲੱਗ ਸਥਿਤੀਆਂ ਵਿੱਚ ਕੱਪੜਿਆਂ ਨੂੰ ਅਲੱਗ ਅਲੱਗ ਤਰੀਕਿਆਂ ਨਾਲ ਸੁਖਾਇਆ ਜਾਂਦਾ ਜਿਵੇਂ ਜੇ ਤਾਂ ਧੁੱਪ ਨਿਕਲੀ ਹੋਵੇ ਤਾਂ ਕੱਪੜਿਆਂ ਨੂੰ ਛੱਤ ਉਤੇ ਪਾ ਦਿੱਤਾ ਜਾਂਦਾ ਹੈ ਜੇਕਰ ਮੀਂਹ ਦਾ ਮੌਸਮ ਹੋਵੇ ਤਾਂ ਅੰਦਰ ਹੀ ਪੱਖਾ ਪੱਖਾ ਚਲਾ ਕੇ ਹਵਾ ਨਾਲ ਉਹ ਕੱਪੜਿਆਂ ਨੂੰ ਸੁਕਾਇਆ ਜਾਂਦਾ ਹੈ ਇਸ ਤੋਂ ਇਲਾਵਾ ਕੱਪੜੇ 'ਚ ਕੱਪੜੇ ਜਿਵੇਂ ਪੱਗ ਜਾਂ ਚੁੰਨੀ ਨੂੰ ਚ ਚੰਗੀ ਤਰ੍ਹਾਂ ਝਾੜਿਆ ਜਾਂਦਾ ਹੈ ਤਾਂ ਕਿ ਉਹ ਜਲਦੀ ਸੁੱਕ ਜਾਣ ਇਸ ਤਰ੍ਹਾਂ ਅਲੱਗ ਅਲੱਗ ਚੀਜ਼ਾਂ ਨੂੰ ਅਲੱਗ ਅਲੱਗ ਤਰੀਕਿਆਂ ਨਾਲ ਸੁਕਾਇਆ ਜਾਂਦਾ ਹੈ ਧੰਨਵਾਦ